ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਓਕੇ ਕਿੰਨੇ ਜਾਣੇ ਓਂ

ਓਕੇ

ਓਕੇ ਤਾਂ ਤੁਸੀਂ ਕਿੰਨੀ ਦੇਰ ਸਟੇਅ ਕਰਨਾ ਇੱਥੇ ਓਕੇ ਠੀਕ ਹੈ ਹਾਂਜੀ ਰੂਮ ਮਿਲ ਜਾਣਗੇ ਤੁਸੀਂ ਦੱਸ ਦਿਓ ਤੁਹਾਨੂੰ ਕਿੰਨੇ ਰੂਮ ਚਾਹੀਦੇ ਨੇ ਗੁਰਦੁਆਰੇ 'ਚ ਓਕੇ ਕਿੰਨੇ ਚਾਹੀਦੇ ਹੈ ਦੋ ਓਕੇ ਓਕੇ ਹਾਂਜੀ ਮਿਲ ਜਾਣਗੇ ਨੋ ਇਸ਼ੂ ਹਾਂਜੀ ਹਾਂਜੀ ਆਲਰੇਡੀ ਕਲੀਨ ਨੇ ਵਿਧ ਬਾਥਰੂਮ ਕਲੀਨ ਹੈ ਸਾਰਾ ਕੁਛ ਪ੍ਰੋਵਾਈਡ ਹੋਏਗਾ ਤੁਹਾਨੂੰ ਥਾਊਂਜੈਂਟ ਤੁਸੀਂ ਆਓਂਗੇ ਤਾਂ ਅਸੀਂ ਉਦੋਂ ਕਰ ਸਕਦੇ ਹਾਂ ਬਟ ਹੁਣੇ ਨਹੀਂ ਅਸੀਂ ਪਹਿਲਾਂ ਦੱਸ ਸਕਦੇ ਹਜੇ ਸਾਡਾ ਇੰਨਾਂ ਹੀ ਪ੍ਰਾਈਜ ਹੈ ਤੁਸੀਂ ਆਉਂਗੇ ਤਾਂ ਉਦੋਂ ਦੇਖ ਲਵਾਂਗੇ ਡਿਸਕਾਊਂਟ ਅਗਰ ਹੋ ਸਕਿਆ ਤਾਂ ਤੁਸੀਂ ਸਾਨੂੰ ਐਗਜੈਕਟ ਡੇਟ ਦੱਸ ਦਿਓ ਤੁਸੀਂ ਕਿਸ ਦਿਨ ਆਉਣਾ ਏ ਫਿਰ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਦਾਂਗੇ ਓਕੇ ਏਲੇਵਨ ਤੋਂ ਕਿੰਨੇ

ਹਾਂਜੀ ਕੋਈ ਗੱਲ ਨਹੀਂ ਤੁਸੀਂ ਆ ਜਾਣਾ ਅਸੀਂ ਪ੍ਰੋਵਾਈਡ ਕਰ ਦਾਂਗੇ ਤੁਹਾਨੂੰ ਤੁਸੀਂ ਆਉਣ ਤੋਂ ਪਹਿਲਾਂ ਇੱਕ ਵਾਰ ਕੋਲ ਕਰ ਦੇਣਾ ਤਾਂ ਕਿ ਅਸੀਂ ਆਪਣੇ ਰੂਮ ਰੈਡੀ ਰੱਖੀਏ ਓਕੇ ਹਾਂਜੀ ਠੀਕ ਹੈ ਥੈਂਕ ਯੂ